ਅੰਮ੍ਰਿਤਸਰ ਦੇ ਵਿੱਚ ਬਹੁਤ ਹੀ ਜ਼ਿਆਦਾ ਮੁੱਖ ਸੱਭਿਆਚਾਰਕ ਮੇਲੇ ਮਨਾਏ ਜਾਂਦੇ ਹਨ ਜਿਨ੍ਹਾਂ ਦੇ ਵਿੱਚ ਮਸ਼ਹੂਰ ਸਾਡੇ ਰਾਮ ਤੀਰਥ ਦੇ ਵਿ ਵਿੱਚ ਸਥਿਤ ਬਾਲਮੀਕ ਆਸ਼ਰਮ ਜਿੱਥੇ ਲਵ ਕੁਸ਼ ਜੀ ਦਾ ਜਨਮ ਹੋਇਆ ਉੱਥੇ ਰਾਮ ਤੀਰਥ 'ਤੇ ਤਿਉਹਾਰ ਮੇਲਾ ਬਹੁਤ ਹੀ ਧੂਮਧਾਮ ਨਾਲ ਉੱਥੇ ਮਨਾਇਆ ਜਾਂਦਾ ਹੈ ਦੂਸਰਾ ਇੱਥੇ ਸਾਡੇ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦੇ ਜਨਮ ਸਥਾਨ ਪਹੁਵਿੰਡ ਵਿਖੇ ਬਹੁਤ ਹੀ ਸ਼ਰਧਾ ਨਾਲ ਉੱਥੇ ਮੇਲਾ ਮਨਾਇਆ ਜਾਂਦਾ ਹੈ ਤੀਸਰਾ ਸਾਡੇ ਛੇਹਰਟਾ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਇੱਕ ਸਾਡੇ ਦੁਰਗਿਆਣਾ ਤੀਰਥ 'ਤੇ ਲੰਗੂਰ ਬੱਚਿਆਂ ਨੂੰ ਮਨਾਉਣ ਦਾ ਤਿਉਹਾਰ ਬਹੁਤ ਹੀ ਸ਼ਰਧਾ ਨਾਲ ਦਿਵਾਲੀ ਦੇ ਲਾਗੇ ਦੁਸਹਿਰੇ 'ਤੇ ਮਨਾਇਆ ਜਾਂਦਾ ਹੈ ਇੱਕ ਸਾਡੇ ਵੱਲਾ ਵਿਖੇ ਬਹੁਤ ਹੀ ਧੂਮਧਾਮ ਨਾਲ ਵੱਲੇ ਦਾ ਮੇਲਾ ਮਨਾਇਆ ਜਾਂਦਾ ਹੈ ਔਰ ਇਸ ਤਰ੍ਹਾਂ ਹੀ ਹੋਰ ਵੀ ਬਹੁਤ ਸਾਰੇ ਮੇਲੇ ਅੰਮ੍ਰਿਤਸਰ ਦੇ ਵਿੱਚ ਵੱਖ ਵੱਖ ਸਮੇਂ 'ਤੇ ਦਿਵਾਲੀ 'ਤੇ ਦੁਸਹਿਰੇ 'ਤੇ ਮਨਾਏ ਜਾਂਦੇ ਹਨ